ਹਾਂ ਮੈਨੂੰ ਚਾਚਾ ਚੌਧਰੀ ਦੀ ਕੋਮਿਕ ਕਿਤਾਬਾਂ ਬਹੁਤ ਹੀ ਵਧੀਆ ਲੱਗਦੀਆਂ ਹਨ ਇਹ ਬਹੁਤ ਹੀ ਮਜ਼ੇਦਾਰ ਹੁੰਦੀਆਂ ਹਨ ਬਹੁਤ ਹੀ ਹਸਾਉਂਦੀਆਂ ਹਨ ਇਸ ਨੂੰ ਪੜ੍ਹ ਕੇ ਬੰਦਾ ਇਕੱਲਾ ਲੋ ਹਾਸੇ ਵਿੱਚ ਲੋਟ ਪੋਟ ਹੋ ਜਾਂਦਾ ਹੈ ਇਸਦੇ ਸਾਰੇ ਕਿਰਦਾਰ ਸਾਰੇ ਪਾਤਰ ਬਹੁਤ ਹੀ ਮਜ਼ੇਦਾਰ ਹਨ ਚਾਚਾ ਚੌਧਰੀ ਇੱਕ ਬਜ਼ੁਰਗ ਇਨਸਾਨ ਲੇਕਿਨ ਬੁੱਧੀਮਾਨ ਇਨਸਾਨ ਆ ਅਤੇ ਉਹਦੇ ਵਿੱਚ ਉਸਦੇ ਨਾਲ ਸਾਬੂ ਹੁੰਦਾ ਹੈ ਇਹ ਜਿਵੇਂ ਕਹਿੰਦੇ ਕਿ ਚਾਚਾ ਚੌਧਰੀ ਦਾ ਦਿਮਾਗ ਕੰਪਿਊਟਰ ਨਾਲੋਂ ਵੀ ਤੇਜ਼ ਚੱਲਦਾ ਹੈ ਉਹ ਬਹੁਤ ਹੀ ਬੁੱਧੀਮਾਨ ਕਰੈਕਟਰ ਵਿਖਾਇਆ ਗਿਆ ਵਾ ਉਹਨਾਂ ਦੀ ਜਿਵੇਂ ਪੁਸ਼ਾਕ ਲਾਲ ਪੱਗੜੀ ਪਾਉਂਦੇ ਹੀ ਲੱਕੜੀ ਦੀ ਛੜੀ ਫੜੀ ਹੁੰਦੀ ਸੀ ਉਹਨਾਂ ਨੇ ਉਹਨਾਂ ਦੀ ਇੱਕ ਜੇਬ ਬਾਸਕਿਟ ਪਾਈ ਹੁੰਦੀ ਸੀ ਉਨ ਨਾਲ ਨਾਲ ਘੜੀ ਪਾਈ ਹੁੰਦੀ ਸੀ ਉਹਨਾਂ ਦੀ ਪਤਨੀ ਦਾ ਨਾਮ ਬਿੰਨੀ ਸੀ ਬਿੰਨੀ ਚਾਚੀ ਕਹਿੰਦੇ ਸੀ ਉਹਨਾਂ ਦੇ ਨਾਲ ਇੱਕ ਵਫਾਦਾਰ ਕੁੱਤਾ ਵੀ ਹੁੰਦਾ ਸੀ ਜਿਹਨੂੰ ਰੌਕਟ ਕਹਿੰਦੇ ਸੀ ਨਾਲ ਸਾਬੂ ਸੀ ਸਾਬੂ ਵੀ ਬਹੁਤ ਹੀ ਹੁਸ਼ਿਆਰ ਦਿਖਾਇਆ ਗਿਆ ਇਹ ਬਹੁਤ ਹੀ ਮਜ਼ੇਦਾਰ ਕਹਾਣੀਆਂ ਸੀ ਇਸਨੂੰ ਪੜ੍ਹ ਕੇ ਬਹੁਤ ਹੀ ਮਜ਼ਾ ਆਉਂਦਾ ਸੀ ਬਹੁਤ ਹੀ ਵਧੀਆ ਲੱਗਦੀਆਂ ਹੀ ਬਹੁਤ ਹੀ ਹਸਾਉਂਦੀਆਂ ਸੀ ਧੰਨਵਾਦ